ਵਿਗਿਆਪਨ ਤਾਂ ਫੇਸਬੁੱਕ ਅਤੇ ਯੂਟਿਊਬ 'ਤੇ ਦਿਖਾਏ ਜਾਂਦੇ ਨੇ ਜੀ ਵਿਗਿਆਪਨ ਜਿਹਦੇ ਕੋਲ ਕੈਮਰਾ ਹੋਊਗਾ ਉਹ ਕਰ ਸਕੂਗਾ ਵਿਗਿਆਪਨ ਔਰ ਵਿਗਿਆਪਨ ਉਹ ਕਰ ਸਕਦੇ ਨੇ ਗੇ ਜਿਨ੍ਹਾਂ ਕੋਲ ਸਾਮਾਨ ਹੈਗਾ ਬਾਕੀ ਇਸ਼ਤਿਹਾਰ ਨੇ ਜੀ ਉਹ ਤਾਂ ਕਾਗਜ਼ ਦੇ ਹੁੰਦੇ ਨੇ ਉਹ ਗਲੀਆਂ ਮੁਹੱਲਿਆਂ ਵਿੱਚ ਲਾ ਕੇ ਛਪਾ ਕੇ ਇਸ਼ਤਿਹਾਰਬਾਜ਼ੀ ਕਰ ਸਕਦੇ ਹਾਂ ਜੀ ਆਪਾਂ ਸਕੂਲਾਂ ਬਾਰੇ ਆਪਣੇ ਬਿਜਨਸ ਬਾਰੇ ਬੱਚਿਆਂ ਦੀ ਪੜ੍ਹਾਈ ਬਾਰੇ ਜੋ ਵੀ ਇਸ਼ਤਿਹਾਰ ਲਾਏ ਜਾਂਦੇ ਨੇ ਗੇ ਉਹ ਬਾਹਰ ਹੀ ਲਾਏ ਜਾਂਦੇ ਨੇ ਗੇ ਸੜਕਾਂ 'ਤੇ ਲਾਏ ਜਾਂਦੇ ਨੇ ਗੇ ਬੋਰਡ ਬਣਾ ਕੇ ਇਸ਼ਤਿਹਾਰ ਲਾਏ ਜਾਂਦੇ ਨੇ ਕਿਸੇ ਕੰਮ ਦੀ ਜਾਣਕਾਰੀ ਦੇਣੀ ਹੈ ਵਿਗਿਆਪਨ ਕਰਨਾ ਹੈ ਬੋਰਡ ਲਗਾਏ ਜਾਂਦੇ ਨੇ ਚੌਂਕਾਂ ਦੇ ਵਿੱਚ ਸੜਕਾਂ ਦੇ ਵਿੱਚ ਆਵਾਜਾਈ ਜਿੱਥੇ ਹੁੰਦੀ ਹੈ ਜਿੱਥੇ ਬਹੁਤ ਲੋਕ ਵੱਧ ਵੱਧ ਲੰਘਦੇ ਨੇ ਗੇ ਮੇਨ ਰੋਡਾਂ ਦੇ ਉੱਤੇ ਲਾਏ ਜਾਂਦੇ ਨੇ ਗੇ ਵੀ ਲੋਕਾਂ ਨੂੰ ਪਤਾ ਲੱਗੇ ਇਹ ਵਿਗਿਆਪਨ ਹੁੰਦਾ ਜੀ ਇਸ਼ਤਿਹਾਰ ਕੰਧਾਂ 'ਤੇ ਲਾਏ ਜਾਂਦੇ ਨੇ ਗੇ ਸਕੂਲਾਂ ਦੇ ਅਡਮੀਸ਼ਨਾਂ ਬਾਰੇ ਲਾਏ ਜਾਂਦੇ ਨੇ ਗੇ ਵੋਟਾਂ ਬਾਰੇ ਲਾਏ ਜਾਂਦੇ ਨੇ ਕਿਸੇ ਦੁਕਾਨ ਦੀ ਮਸ਼ਹੂਰੀ ਬਾਰੇ ਲਾਏ ਜਾਂਦੇ ਨੇ ਉਹ ਇਸ਼ਤਿਹਾਰ ਹੁੰਦੇ ਨੇ ਜੀ ਉਹ ਕੰਮ ਕਾਰ ਵੀ ਸਾਡਾ ਵਧੇ ਕਾਰੋਬਾਰ ਵਧੇ ਬਹੁਤ ਲੋਕਾਂ ਨੂੰ ਰੁਜ਼ਗਾਰ ਮਿਲੇ ਜੋ ਪੜ੍ਹ ਕੇ ਸਾਡੇ ਤੱਕ ਆ ਸਕਣ ਇਹ ਰਚਮਾਤਮਕ ਪ੍ਰਭਾਵਸ਼ਾਲੀ ਹੁੰਦੇ ਨੇ ਜੀ ਜੋ ਪੜ੍ਹਦਾ ਹੈ ਉਸ 'ਤੇ ਪ੍ਰਭਾਵਿਤ ਹੁੰਦਾ ਹੈ ਸੋ ਪੜ੍ਹ ਕੇ ਜਾਂਦਾ ਵੀ ਹੈ ਜਿਸ ਨੂੰ ਚਾਹਨਾ ਹੁੰਦੀ ਹੈ ਜੀ ਕੰਮ ਕਰਨ ਦੀ ਉੱਥੇ ਪਹੁੰਚ ਕੇ ਆਪਦੇ ਕੰਮ ਵਾਸਤੇ ਉੱਥੇ ਜਾਂਦਾ ਹੈ ਜੀ ਕੰਮ ਮਿਲ ਜਾਂਦਾ ਹੈ ਗਾ ਜੇ ਆਪਾਂ ਇਸ਼ਤਿਹਾਰਬਾਜ਼ੀ ਨਹੀਂ ਕਰਾਂਗੇ ਵਿਗਿਆਪਨ ਨਹੀਂ ਪਾਵਾਂਗੇ ਲੋਕਾਂ ਨੂੰ ਰੁਜ਼ਗਾਰ ਬਾਰੇ ਨਹੀਂ ਪਤਾ ਲੱਗਦਾ ਜੋ ਬੱਚੇ ਬੇਰੁਜ਼ਗਾਰ ਨੇ ਉਹ ਪੜ੍ਹ ਕੇ ਇਸ਼ਤਿਹਾਰ ਉੱਥੇ ਜਾ ਪਹੁੰਚਦੇ ਨੇ ਆਪਦੀਆਂ ਡਿਗਰੀਆਂ ਲੈ ਕੇ ਉਨ੍ਹਾਂ ਨੂੰ ਰੁਜ਼ਗਾਰ ਮਿਲ ਜਾਂਦਾ ਹੈ ਅਤੇ ਜੋ ਕੰਮ ਕਰਨ ਵਾਲੇ ਉਨ੍ਹਾਂ ਨੂੰ ਕੰਮ ਮਿਲ ਜਾਂਦਾ ਹੈ